ਮੌਜੂਦਾ ਘਟਨਾ ਜਾਂ ਖਬਰ ਜਿਹੜੀ ਦਿਲਚਸਪ ਲੱਗੀ ਸੀ ਨੇੜੇ ਜੇ ਇੱਕ ਤਾਂ ਕਾਫੀ ਪਹਿਲਾਂ ਜਦੋਂ ਅਲੋਨ ਮਸਕ ਨੇ ਆਪਣੇ ਬੱਚੇ ਦਾ ਨਾਮ ਐਕਸ ਏ ਈ ਏ ਟਵੈਲਵ ਰੱਖਿਆ ਸੀ ਜਿਹੜਾ ਕਿ ਨੰਬਰਾਂ ਨਾਲ ਬਣਿਆ ਹੋਇਆ ਨਾਮ ਸੀ ਸ਼ਬਦਾਂ ਦਾ ਨਹੀਂ ਇਹ ਮੈਨੂੰ ਬੜਾ ਦ ਹਾਸਜਨਕ ਅਤੇ ਹੈਰਾਨੀਜਨਕ ਲੱਗਿਆ ਸੀ ਕਿ ਕਿਸ ਤਰ੍ਹਾਂ ਜਿਹੜੀ ਟੈਕਨਾਲਜੀ ਆ ਉਹ ਮਨੁੱਖੀ ਜੀਵਨ ਦਾ ਇੰਨਾਂ ਗੂੜ੍ਹਾ ਅੰਗ ਬਣ ਚੁੱਕੀ ਹੈ ਕਿ ਸ਼ਬਦਾਂ ਤੋਂ ਟੁੱਟ ਕੇ ਲੋਕ ਤਕਨਾਲੋਜੀ ਨਾਲ ਹੀ ਜੁੜ ਰਹੇ ਹਨ ਉਹਨੇ ਆਪਣੀ ਦੂਜੇ ਬੱਚੇ ਦਾ ਨਾਮ ਟੈਕਨੋ ਮਕੈਨਿਕਸ ਵੀ ਰੱਖਿਆ ਹੋਇਆ ਹੈ ਅਤੇ ਜੋ ਆਪਣੇ ਆਪ ਦੇ ਅੰਦਰ ਬੜਾ ਹੀ ਇੱਕ ਅਲੱਗ ਤਰੀਕੇ ਦਾ ਅਲੱਗ ਨਾਮ ਹੈ ਅਤੇ ਇੰਟਰਸਟਿੰਗ ਵੀ ਹੈ ਖਾ ਅਲੱਗ ਹੈ ਦੂਜਾ ਇਕ ਹੋਰ ਖਬਰ ਆਈ ਸੀ ਉਸ ਤੋਂ ਬਾਅਦ ਕਿ ਅਮਰੀਕਾ ਨੇੜੇ ਸਮੁੰਦਰ ਦੇ ਅੰਦਰ ਇੱਕ ਸਬਮਰੀਨ ਨੂੰ ਟੈਸਟ ਕਰਦੇ ਹੋਏ ਇੱਕ ਗੇਮ ਸਿਰਫ ਇੱਕ ਔਨਲਾਈਨ ਟੈਕਨੀਕਲ ਗੇਮ ਖੇਡਦੇ ਹੋਏ ਬਹੁਤ ਸਾਰੇ ਮਿਲੇਨੇਰ ਅਤੇ ਬਿਲੇਨੇਰ ਉਹ ਜਿਹੜੀ ਇੱਕ ਸੰਮਰੀਨ ਸਟੱਡੀ ਹੋਈ ਸੀਗੇ ਖੇਡਣ ਵਜੋਂ ਉਹ ਸੰਮਰੀਨ ਕਿਉਂਕਿ ਡੁੱਬੀ ਅਤੇ ਉਹ ਨਾਲ ਹੀ ਖੇਡ ਖੇਡ ਦੇ ਵਿੱਚ ਆਪ ਵੀ ਸਾਰੇ ਜਾਣੇ ਡੁੱਬ ਗਏ ਇਹ ਮੈਨੂੰ ਬੜੀ ਹੈਰਾਨੀ ਲੱਗੀ ਸੀ ਕਿ ਕਿ ਤਰ੍ਹਾਂ ਜਿਹੜਾ ਆਪਣੀ ਜੀਵਨ ਹੈ ਉਹਦੀ ਵੀ ਕਦਰ ਨਹੀਂ ਕੀਤੀ ਜਾ ਰਹੀ ਅਤੇ ਇੰਨਾਂ ਪੈਸਾ ਕਮਾ ਕੇ ਜਿਹੜਾ ਇਹ ਪੂੰਜੀਵਾਦ ਦਾ ਯੁੱਗ ਹੈ ਇਹਦੇ ਅੰਦਰ ਅਮੀਰ ਲੋਕ ਜਸ਼ਨ ਵਜੋਂ ਬਸ ਡੁੱਬ ਮਰ ਰਹੇ ਹਨ ਅਤੇ ਇਸ ਧਰਤੀ ਨੂੰ ਵੀ ਡੁਬੋ ਰਹੇ ਹਨ ਕੰਪਨੀਆਂ ਦੀ ਦੌੜ ਦੇ ਅੰਦਰ ਇਹ ਤੋਂ ਪਹਿਲਾਂ ਜੈਫ ਬੇਜੋਸ ਦੀ ਜਦੋਂ ਲੋਕਾਂ ਨੇ ਐਮੇਜ਼ੋਨ ਦੇ ਅਗੇਂਨਸਟ ਧਰਨੇ ਲਾਉਂਦੇ ਹੋ ਅਤੇ ਦੁੱਖ ਦਾ ਇਜ਼ਹਾਰ ਕਰਦਿਆਂ ਇਹ ਨਾਰਾ ਦਿੱਤਾ ਸੀ ਕਿ ਐਮਜੋਨ ਕੰਪਨੀ ਦੇ ਸੀ ਈ ਓ ਜੈਫ ਬੇਜੋਸ ਜਦੋਂ ਉਹ ਬਾਹਰ ਜਿਹੜਾ ਖਲਾਅ ਖਲਾਅ ਹੈ ਪੁਲਾੜ ਦਾ ਬ੍ਰਹਿਮੰਡ ਦਾ ਦੌਰਾ ਕਰਨ ਗਿਆ ਸੀ ਬਾਹਰ ਮਾਰਸ ਤੱਕ ਸਪੇਸਸਿਪ 'ਤੇ ਧਰਤੀ ਤੋਂ ਉੱਪਰ ਕਿ ਉਹਨੂੰ ਵਾਪਸ ਧਰਤੀ ਦੇ ਅੰਦਰ ਨਾ ਵਾੜਿਆ ਜਾਵੇ ਉਹਦੇ ਸਪੇਸਸ਼ਿਪ ਨੂੰ ਬਾਹਰ ਹੀ ਘੁੰਮਦਾ ਰਹਿਣ ਦਿੱਤਾ ਜਾਵੇ ਕਿਉਂਕਿ ਉਹ ਤੋਂ ਲੋਕ ਬਹੁਤ ਤੰਗ ਸੀ ਤਾਂ ਇਹ ਜਿਹੜਾ ਕੋਂਟਰਾਸਟ ਜਿਹੜਾ ਇਹ ਦੋ ਪੱਖ ਦੋ ਜ਼ਿੰਦਗੀ ਦੇ ਨਜ਼ਰੀਏ ਸਾਹਮਣੇ ਆ ਰਹੇ ਹਨ ਜੈਫ ਬੇਜੋਸ ਦੀ ਅੰਤ ਅੰਤ ਅੰਤ ਦੀ ਅਮੀਰੀ ਅਤੇ ਉਸ ਦਾ ਧਰਤੀ ਦੇ ਬਾਹਰ ਘੁੰਮਣ ਜਾਣਾ ਇੱਕ ਰੋਕੇਟ 'ਤੇ ਜਿਹਦੇ ਨਾਲ ਕਿੰਨਾਂ ਹੀ ਪ੍ਰਦੂਸ਼ਣ ਧਰਤੀ 'ਤੇ ਹੋਇਆ ਹੋਵੇਗਾ ਕਿੰਨਾ ਹੀ ਪੰ ਕਿੰਨੇ ਹੀ ਪੰਛੀ ਜਾਨਵਰਾਂ ਦਾ ਘਾਤ ਹੋਇਆ ਹੋਵੇਗਾ ਇਹਦਾ ਕੋਈ ਖੋਜ ਇਹ ਕ ਫਿਰ ਇਹਦਾ ਆਧਾਰ ਨਹੀਂ ਸੀ ਸਿੰਪਲ ਸਿਰਫ ਕੇਵਲ ਘੁੰਮਣ ਫਿਰਨਾ ਸੀ ਦੂਜਾ ਕਿੰਨੇ ਹੀ ਹਜ਼ਾਰਾਂ ਜਿਹੜੇ ਕਾਮੇ ਸੀ ਐਮਾਜ਼ੋਨ ਦੇ ਉਹਨਾਂ ਦਾ ਦੁੱਖ ਉਹਨਾਂ ਦੀ ਆਵਾਜ਼ ਜਿਹੜੀ ਕਿ ਚੰਗੀ ਤਰ੍ਹਾਂ ਸੁਣੀ ਨਹੀਂ ਗਈ ਹੁਣ ਤੱਕ ਅਤੇ ਇੱਦਾਂ ਦੇ ਹੋਰ ਹੀ ਹਜਾਰਾਂ ਘਟਨਾ ਜਿਹੜੀਆਂ ਰੋਜ਼ ਰੋਜ਼ ਆਮ ਤੌਰ 'ਤੇ ਹੋ ਰਹੀਆਂ ਹਨ ਇਹ ਅੱਜ ਕੱਲ੍ਹ ਦੀਆਂ ਖਬਰਾਂ ਦਾ ਇੱਕ ਦਿਲਚਸਪ ਅਤੇ ਹੈਰਾਨੀਜਨਕ ਹਿੱਸਾ ਬਣ ਜਾਂਦੀਆਂ ਨੇ